ਪੰਜਾਬੀ ਸਭਿਆਚਾਰ ਵਿੱਚ ਭੰਗੜੇ ਦਾ ਬਹੁਤ ਹੀ ਮਹੱਤਵ ਹੈ ਅਸੀਂ ਕਿਸੇ ਵਿਆਹ 'ਤੇ ਜਾਣਾ ਹੋਵੇ ਕਿਸੇ ਬੱਚੇ ਦੇ ਜਨਮ 'ਤੇ ਜਾਣਾ ਹੋਵੇ ਅਸੀਂ ਕਿਸੇ ਵੀ ਫੰਕਸ਼ਨ 'ਤੇ ਕਿਸੇ ਵੀ ਤਿਉਹਾਰ 'ਤੇ ਜਾਣਾ ਹੋਵੇ ਤਾਂ ਇਸ ਬਿਨ੍ਹਾਂ ਭੰਗੜਾ ਸਾਡਾ ਫਿੱਕਾ ਹੈ ਭੰਗੜੇ ਬਿਨ੍ਹਾਂ ਹਰ ਤਿਉਹਾਰ ਫਿੱਕਾ ਹੈ ਅਸੀਂ ਭੰਗੜਾ ਹਰ ਜਗ੍ਹਾ 'ਤੇ ਕਿਤੇ ਵੀ ਕੋਈ ਫੰਕ ਕੋਈ ਬੱਚਿਆਂ ਦੇ ਸਕੂਲ ਫੰਕਸ਼ਨ ਹੈ ਕੋਈ ਆਪਣੇ ਘਰ ਦਾ ਫੰਕਸ਼ਨ ਹੈ ਤਾਂ ਆਪਾਂ ਭੰਗੜੇ ਨੂੰ ਹਰ ਚੀਜ਼ 'ਚ ਪਹਿਲ ਦਿੰਦੇ ਹਾਂ ਇਹ ਪੰਜਾਬ ਦਾ ਹੀ ਨਹੀਂ ਇਹ ਪੂਰੇ ਭਾਰਤ ਦਾ ਹੀ ਭੰਗੜਾ ਮਹੱਤਵ ਬਣ ਗਿਆ ਹੈ ਇਸ ਵਿੱਚ ਸਾਡੇ ਪੰਜਾਬ ਦੇ ਵੱਖ ਵੱਖ ਜਿਹੜੇ ਗਾਇਕ ਨੇ ਉਹ ਬਾਹਰ ਫੋਰਨ ਕੰਟਰੀਆਂ 'ਚ ਜਾ ਕੇ ਜਿਵੇਂ ਕਨੇਡਾ ਆਸਟਰੇਲੀਆ ਇੰਗਲੈਂਡ ਕਈ ਜਗ੍ਹਾ 'ਤੇ ਜਾ ਕੇ ਆਪਣੇ ਇਸ ਸੱਭਿਆਚਾਰ ਨੂੰ ਭੰਗੜੇ ਨੂੰ ਪਹਿਲ ਦੇਣ ਲੱਗ ਗਏ ਹਨ ਅਤੇ ਆਪ ਖੁਦ ਉਹਨਾਂ ਬਾਰੇ ਗਾ ਕੇ ਅਤੇ ਲੋਕਾਂ ਨੂੰ ਭੰਗੜੇ ਵਿੱਚ ਅੱਗੇ ਲਿਆਉਂਦੇ ਹਨ ਤਾਂ ਸਮੇਂ ਦੇ ਨਾਲ ਨਾਲ ਪੰਜਾਬ ਦੇ ਤਿਉਹਾਰ ਦਾ ਇੱਕ ਇਹ ਮਹੱਤਵਪੂਰਨ ਹਿੱਸਾ ਵੀ ਇਸ ਤਰ੍ਹਾਂ ਹੀ ਬਣਿਆ ਹੈ ਕਿ ਆਪਾਂ ਹਰੇਕ ਤਿਉਹਾਰ 'ਤੇ ਹਰੇਕ ਦਿਵਾਲੀ ਹੋਵੇ ਭਾਵੇਂ ਲੋਹੜੀ ਹੋਵੇ ਭਾਵੇਂ ਹੋਲੀ ਹੋਵੇ ਆਪਾਂ ਵੱਖ ਵੱਖ ਤਰ੍ਹਾਂ ਦੇ ਹਰੇਕ ਤਿਉਹਾਰ ਵਿੱਚ ਭੰਗੜੇ ਨੂੰ ਪਹਿਲ ਦੇਣ ਲੱਗ ਗਏ ਹਾਂ